ਸਾਡੇ ਖੇਤਰ ਦਾ ਮੌਸਮ ਫਸਲਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਸਾਡੇ ਖੇਤਰ ਵਿੱਚ ਕਣਕ ਦੀ ਬਿਜਾਈ ਹੁੰਦੀ ਹੈ ਜਦੋਂ ਕਣਕ ਦੀ ਬਿਜਾਈ ਹੁੰਦੀ ਹੈ ਉਹ ਸਹੀ ਹੋ ਜਾਂਦੀ ਹੈ ਪਰ ਜਦੋਂ ਉਨ ਦੀ ਕਟਾਈ ਹੁੰਦੀ ਹੈ ਤਾਂ ਉਸ ਸਮੇਂ ਬਹੁਤ ਜ਼ਿਆਦਾ ਮੀਹ ਪੈ ਜਾਂਦੇ ਹੈ ਜਿਸਦੇ ਕਰਕੇ ਫਸਲ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਕੱਟਣ ਵਿੱਚ ਪ੍ਰੋਬਲਮ ਆਉਂਦੀ ਹੈ ਜਿਸਦੇ ਕਰਕੇ ਕਈ ਵਾਰ ਫਸਲ ਕਾਲੀ ਵੀ ਹੋਣ ਲੱਗ ਜਾਂਦੀ ਹੈ ਅਤੇ ਹੋਰ ਬਹੁਤ ਜ਼ਿਆਦਾ ਸਮੱਸਿਆਵਾਂ ਆਉਂਦੀਆਂ ਜਿਵੇਂ ਕਿ ਫੈਕਟਰੀ ਦੀ ਸਮੱਸਿਆ ਫੈਕਟਰੀਆਂ ਦਾ ਧੂੰਆਂ ਉਹ ਵੀ ਬਹੁਤ ਜ਼ਿਆਦਾ ਤੰਗ ਕਰਦਾ ਹੈ ਅਤੇ ਇਸ ਦੇ ਨਾਲ ਬ ਲੋਕਾਂ ਨੂੰ ਬਹੁਤ ਜਾਣੀ ਅ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜਿਸ ਦੇ ਕਾਰਨ ਉਹਨਾਂ ਦ ਇਸ ਦਾ ਕੋਈ ਵੀ ਹੱਲ ਨਹੀਂ ਮਿਲਦਾ ਹੈ ਵੀ ਉਹ ਆਪਣੀਆਂ ਫਸਲਾਂ ਨੂੰ ਸਹੀ ਕਿਸ ਤਰ੍ਹਾਂ ਰੱਖਣ ਜਿਸ ਦੇ ਕਾਰਨ ਉਹਨਾਂ ਨੂੰ ਖਾਣ ਦੇ ਲਈ ਪੂਰਾ ਪ੍ਰੋਪਰ ਅਨਾਜ ਨਹੀਂ ਮਿਲਦਾ ਹੈਗਾ

ਵਧੀਆ ਹੋਊਂਗੀ ਅਤੇ ਉਹ ਕਣਕ ਜਦੋਂ ਵਧੀਆ ਹੋਣ ਲੱਗੂਗੀ ਤਾਂ ਉਹਨਾਂ ਨੂੰ ਸਹੀ ਅਨਾਜ ਮਿਲੂਗਾ ਉਹਨਾਂ ਦੀ ਸਿਹਤ 'ਤੇ ਵਧੀਆ ਇਫੈਕਟ ਪਉਂਗਾ ਅਤੇ ਜਿਸ ਦੇ ਨਾਲ਼ ਉਸਦੀ ਬ ਹੈਲਪ ਹੋਰ ਵੀ ਬਹੁਤ ਸਾਰੀਆਂ ਹੈਲਪਸ ਉਹਨਾਂ ਨੂੰ ਮਿਲ ਸਕਦੀਆਂ ਹਨ ਅਤੇ ਉਹ ਵਧੀਆ ਮਸ਼ੀਨਰੀ ਵੀ ਪ੍ਰੋਵਾਈਡ ਕਰ ਸਕਦੇ ਹਨ ਅਤੇ ਜਿਸ ਦੇ ਨਾਲ਼ ਵਧੀਆ ਮਸ਼ੀਨਰੀ ਮਿਲਣ ਦੇ ਨਾਲ਼ ਕਣਕਾਂ ਦੀ ਬਿਜਾਈ ਹੋਰ ਵੀ ਜ਼ਿਆਦਾ ਵਧੀਆ ਹੋਊਂਗੀ ਅਤੇ ਕਣਕ ਹੋਰ ਜ਼ਿਆਦਾ ਵਧੀਆ ਹੋਣ ਲੱਗੇਗੀ ਜਿਸ ਦੇ ਨਾਲ਼ ਉਹਨਾਂ ਨੂੰ ਕਣਕ ਦੇ ਵਿੱਚ ਬਹੁਤ ਜ਼ਿਆਦਾ ਮਹਿੰਗ ਲਾਭ ਪ੍ਰਾਪਤ ਹੋ ਪਾਊਂਗਾ